ਸਭ ਤੋਂ ਚੁਣੌਤੀਪੂਰਨ ਵਿਅੰਜਨ ਜਦੋਂ ਭੋਜਨ ਨੂੰ ਤਿਆਰ ਕਰਨ ਦਾ ਜੋ ਸਿੱਖਿਆ ਹਾਸਿਲ ਕਰਨ ਦਾ ਅਵਸਰ ਪ੍ਰਾਪਤ ਹੋਇਆ ਤਾਂ ਸਭ ਤੋਂ ਔਖਾ ਸੀ ਆਟਾ ਗੁੰਨਣਾ ਪ੍ਰੰਤੂ ਅਭਿਆਸ ਦੇ ਨਾਲ ਹੌਲੀ ਹੌਲੀ ਕਿਵੇਂ ਜੋ ਸੁੱਕੇ ਆਟੇ ਦੇ ਵਿੱਚ ਕਿੰਨਾ ਪਾਣੀ ਮਿਲਾਉਣਾ ਹੈ ਅਤੇ ਉਹਨੂੰ ਮਿਲਾਉਂਦਿਆਂ ਕਿਵੇਂ ਗੁੰਨਣਾ ਹੈ ਅਤੇ ਉਸ ਤੋਂ ਬਾਅਦ ਹੱਥ ਦੀ ਮੁੱਕੀ ਬਣਾ ਕੇ ਉਹਨੂੰ ਕਿੱਦਾਂ ਗੁੰਨਣਾ ਹੈ ਅਤੇ ਪਾਣੀ ਦੀ ਸੁਚੱਜੀ ਵਰਤੋਂ ਦੇ ਨਾਲ ਉਹਨੂੰ ਕਿਵੇਂ ਜੋ ਹੈ ਉਹ ਰੋਟੀ ਦਾ ਪੇੜਾ ਬਣਾਉਣ ਲਈ ਤਿਆਰ ਕਰਨਾ ਹੈ ਅਤੇ ਇਹ ਕਿਸੇ ਵੀ ਸਿਖਾਂਦਰੂ ਲਈ ਚੁਣੌਤੀਪੂਰਨ ਅ ਜੋ ਵਿਅੰਜਨ ਕਹਿ ਲਉ ਜਾਂ ਰੋਟੀ ਕਹਿ ਲਉ ਉਹਨੂੰ ਤਿਆਰ ਕਰਨ ਲਈ ਜਿਹੜਾ ਹੈ ਉਹ ਜਦੋਂ ਸਿੱਖਿਆ ਹਾਸਲ ਕਰਦੇ ਹਾਂ ਤਾਂ ਉਹ ਅ ਉਹ ਅਨੁਭਵ ਜਿਹੜਾ ਹੈ ਵਿਲੱਖਣ ਹੁੰਦਾ ਹੈ